ਅੱਜ ਦੇ ਸੰਸਾਰ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਬੋਲਣ ਵਾਲਿਆਂ ਲਈ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਹੈ ਉਹਨਾਂ ਨੂੰ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਅੱਜ ਕੱਲ੍ਹ ਕਿਆ ਹੈ ਪੰਜਾਬੀ ਮਤਲਬ ਪੰਜਾਬੀ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਘੱਟ ਹੋ ਬੋਲਣ ਵਾਲੇ ਲੋਕ ਬਹੁਤ ਜ਼ਿਆਦਾ ਘੱਟ ਹੋ ਗਏ ਨ ਅਤੇ ਇੰਗਲਿਸ਼ ਅਤੇ ਹਿੰਦੀ ਬੋਲਣ ਵਾਲੇ ਲੋਕ ਹੈ ਬਹੁਤ ਜ਼ਿਆਦਾ ਵੱਧ ਗਏ ਹਨ ਇਸ ਦਾ ਇਹ ਦਾ ਵੱਡਾ ਪ੍ਰਭਾਵ ਇਹ ਹੈ ਕਿ ਜਿਹੜੇ ਸਾਰੇ ਜਿਹੜੇ ਲੋਕ ਹੈ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜਨੇ ਪਾ ਰਹੇ ਨੇ ਅਤੇ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਨ ਦੇ ਨਾਲ ਜਿਹੜੇ ਬੱਚੇ ਹੈ ਉੱਥੇ ਦੇ ਟੀਚਰਸ ਹੈ ਉਹ ਟੀਚਰ ਸਾਰੇ ਬੱਚਿਆਂ ਨੂੰ ਕਿਆ ਏ ਇੰਗਲਿਸ਼ ਬੋਲਣੀ ਜਿਹੜੀ ਹੈਗੀ ਆ ਉਹ ਸਿਖਾ ਰਹੇ ਨੇ ਇੰਗਲਿਸ਼ ਬੋਲਣ ਕਰਕੇ ਜਿਹੜੇ ਬੱਚੇ ਆ ਉਹ ਇੰਗਲਿਸ਼ ਬੋਲਦੇ ਨੇ ਤੇ ਇੰਗਲਿਸ਼ ਬੋਲਦੇ ਨੇ ਤੇ ਉਹ ਘਰੇ ਜਾ ਕੇ ਜਦੋਂ ਪੰਜਾਬੀ ਦੇ ਵਿੱਚ ਉਹਨਾਂ ਦੇ ਘਰ ਦੇ ਤਾਂ ਪੰਜਾਬੀ ਵਿੱਚ ਬੋਲਦੇ ਨੇ ਪਰ ਪੰਜਾਬੀ ਵਿੱਚ ਬੋਲਣ ਦੇ ਨਾਲ ਉਹਨਾਂ ਦੇ ਘਰ ਦੇ ਉਹਨਾਂ ਨੂੰ ਪੰਜਾਬੀ ਵਿੱਚ ਗੱਲ ਨਹੀਂ ਕਰਨ ਦਿੰਦੇ ਉਹਨਾਂ ਨੂੰ ਕਹਿੰਦੇ ਕਿ ਉਹ ਘਰ ਵਿੱਚ ਵੀ ਕਿਆ ਏ ਹਿੰਦੀ ਭਾਸ਼ਾ ਦੀ ਵਰਤੋਂ ਮਤਲਬ ਵਰਤੋਂ ਕਰਨ ਪਰੰਤੂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਏ ਉਹ ਮਤਲਬ ਅੱਜ ਕੱਲ੍ਹ ਇੰਗਲਿਸ਼ ਔਰ ਹਿੰਦੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਪੰਜਾਬੀ ਨੂੰ ਨਹੀਂ ਦਿੱਤੀ ਜਾਂਦੀ ਜਿਹੜੀ ਪੰਜਾਬੀ ਲੈਂਗੁਏਜ ਹੈ ਇਹਨੂੰ ਕਿਹਾ ਜਾਂਦਾ ਏ ਕਿ ਇਹ ਤਾਂ ਐਵੇਂ ਹੀ ਮਤਲਬ ਕੋਈ ਵੀ ਲੈਂਗੁਏਜ ਹੈ ਇਹਨੂੰ ਕੋਈ ਵੀ ਈ ਵਧੀਆ ਮਤਲਬ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਵਧੀਆ ਸਥਾਨ ਪ੍ਰਾਪਤ ਨਹੀਂ ਹੈ ਸਕੂਲਾਂ ਦੇ ਵਿੱਚ ਇੰਗਲਿਸ਼ ਬੋਲਣ ਦੇ ਨਾਲ ਟੀਚਰ ਇੰਗਲਿਸ਼ ਬੋਲਦੇ ਹਨ ਅਤੇ ਬੱਚਿਆਂ ਨੂੰ ਵੀ ਇੰਗਲਿਸ਼ ਹੀ ਸਿਖਾਈ ਜਾਂਦੀ ਹੈ ਜੇਕਰ ਕਿਸੇ ਸਕੂਲ ਦੇ ਵਿੱਚ ਇੰਗਲਿਸ਼ ਨਹੀਂ ਹੈ ਤਾਂ ਉੱਥੇ ਹਿੰਦੀ ਬੋਲੀ ਜਾਂਦੀ ਹੈ ਬੱਚੇ ਆਪਸ ਦੇ ਵਿੱਚ ਹਿੰਦੀ ਦੇ ਵਿੱਚ ਗੱਲ ਕਰਦੇ ਹਨ ਕਈ ਸਕੂਲਾਂ ਦੇ ਵਿੱਚ ਤਾਂ ਅਜਿਹਾ ਵੀ ਹੈ ਕਿ ਜਿਹੜੇ ਬੱਚੇ ਹੈ ਜੇਕਰ ਉਹ ਪੰਜਾਬੀ ਦੇ ਵਿੱਚ ਗੱਲ ਕਰਨਗੇ ਤਾਂ ਉਹਨਾਂ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਉਤੇ ਫਾਇਨ ਦਿੱਤਾ ਜਾਂਦਾ ਹੈ ਫਾਇਨ ਦੇ ਕਰਕੇ ਸਾਰੇ ਬੱਚੇ ਕਿਆ ਹੈ ਪੰਜਾਬੀ ਵਿਚ ਪੰਜਾਬੀ ਵਿੱਚ ਗੱਲ ਕਰਨ ਦੀ ਜਗ੍ਹਾ ਹਿੰਦੀ ਜਾਂ ਇੰਗਲਿਸ਼ ਨੂੰ ਹੀ ਜ਼ਿਆਦਾ ਵਰਤੋਂ ਵਿੱਚ ਲਿਆਉਂਦੇ ਹਨ ਅਤੇ ਉਹ ਘਰ ਆ ਕੇ ਵੀ ਜਿੱਦਾਂ ਸਕੂਲ ਵਿੱਚ ਗੱਲ ਕਰਦੇ ਹਨ ਉੱਦਾਂ ਹੀ ਘਰੇ ਆ ਕੇ ਗੱਲ ਕਰਦੇ ਹਨ ਜਿਸ ਦੇ ਕਾਰਨ ਕਿਆ ਹੈ ਕਿ ਜਿਹੜੇ ਘਰ ਦੇ ਵੀ ਬੱਚਿਆਂ ਦੇ ਨਾਲ ਇੰਗਲਿਸ਼ ਹਿੰਦੀ ਵਿੱਚ ਗੱਲ ਕਰਦੇ ਹਨ ਅਤੇ ਇਹਦੇ ਨਾਲ ਕਿਆ ਏ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਬੋਲਣੀ ਹੈ ਇਹ ਬਹੁਤ ਜ਼ਿਆਦਾ ਘੱਟ ਗਈ ਹੈ ਸਾਡਾ ਜਿਹੜਾ ਸੱਭਿਆਚਾਰ ਹੈ ਪੰਜਾਬੀ ਭਾਸ਼ਾ ਬੋਲਣ ਵਾਲਾ ਸੱਭਿਆਚਾਰ ਬਹੁਤ ਜ਼ਿਆਦਾ ਪਿੱਛੇ ਰਹਿ ਚੁੱਕਾ ਹੈ ਪਿੱਛੇ ਰਹਿਣ ਦੇ ਨਾਲ ਨਾਲ ਇਹ ਸਾਡਾ ਸੱਭਿਆਚਾਰ ਦੇ ਵਿੱਚ ਬਹੁਤ ਵੱਡੀ ਚੁਣੌਤੀ ਆਈ ਹੈ ਜਿਹਦੇ ਕਰਕੇ ਸਾਡਾ ਸੱਭਿਆਚਾਰ ਬਹੁਤ ਜ਼ਿਆਦਾ ਹੀ ਪਿਛੜ ਗਿਆ ਹੈ